ਹਾਂਜੀ ਵਾਹਿਗੁਰੂ ਵਾਹਿਗੁਰੂ ਖ਼ਾਲਸਾ ਜੀ ਫਤਹਿ ਜੀ ਹਾਂਜੀ ਅਸੀਂ ਨਾ ਤੁਹਾਡੀ ਦੁਕਾਨ ਤੋਂ ਅ ਲੈ ਕੇ ਗਏ ਸੀਗੇ ਆਪਣਾ ਹਾਂ ਲੈ ਕੇ ਗਏ ਸੀਗੇ ਮੇਜ ਅਤੇ ਬੈੱਡ ਅਤੇ ਉਹ ਹੁਣ ਪਰਵਾਰ ਦੀ ਸਲਾਹ ਸੀ ਵੀ ਅਸੀਂ ਉਹ ਵਾਪਸ ਕਰਨਾ ਚਾਹੁੰਦੇ ਸੀਗੇ ਅਤੇ ਉਹਨਾਂ ਨੂੰ ਐਂ ਸੀ ਵੀ ਉਹ ਜੇ ਤੁਸੀਂ ਵਾਪਸ ਕਰ ਲਉਂਗੇ ਤਾਂ ਅਸੀਂ ਹੋਰ ਹੋਰ ਕਵਾਲਟੀ ਦਾ ਦੇਖਣਾ ਚਾਹੁੰਦੇ ਸੀ ਉਹ ਓ ਨਹੀਂ ਕਰਸ ਸਾਡੀ ਤਾਂ ਰੇਕੁਐਸਟ ਹੀ ਹੈ ਵੀ ਬੇਨਤੀ ਹੈ ਕਿ ਅਸੀਂ ਤੁਹਾਡੀ ਦੁਕਾਨ 'ਤੇ ਪਹਿਲੀ ਵਾਰ ਆਏ ਸੀਗੇ ਵੀ ਅਸੀਂ ਉਹ ਉਹ ਸਾਡੇ ਪਰਵਾਰ ਨੂੰ ਸੈੱਟ ਨਹੀਂ ਨਾ ਬੈਠੀ ਇਸ ਕਰਕੇ ਅਸੀਂ ਉਹ ਵਾਪਸ ਕਰਨਾ ਚਾਹੁੰਦੇ ਸੀਗੇ ਵੀ ਅਸੀਂ ਵਾਪਸ ਕਰਕੇ ਅਸੀਂ ਪੈਸੇ ਨਹੀਂ ਤੁਹਾਡੇ ਤੋਂ ਵਾਪਸ ਲੈਣੇ ਅਤੇ ਅਸੀਂ ਹੋਰ ਹੋਰ ਬੈੱਡ ਦੇਖ ਲਵਾਂਗੇ ਹੋਰ ਕਵਾਲਟੀ 'ਚ ਦੇਖ ਲਾਂਗੇ ਵਧੀਆ ਕਵਾਲਟੀ ਹਾਂ ਉਹ ਬਿੱਲ ਦਿੱਤਾ ਸੀਗਾ ਇੱਥੋਂ ਬਣਾ ਕੇ ਅਤੇ ਉਹ ਸਾਡੇ ਕੋਲ ਹੈ ਹਾਂਜੀ ਹਾਂਜੀ ਬਸ ਸਾਡੀ ਇਹ ਬੇਨਤੀ ਹੋਈ ਸੀਗੀ ਅਤੇ ਵੀ ਜੇ ਤੁਸੀਂ ਵਾਪਸ ਕਰ ਲਉਂਗੇ ਤਾਂ ਵੀ ਅਸੀਂ ਚਾਹੁੰਦੇ ਸੀਗੇ ਅਸੀਂ ਹੋਰ ਵਧੀਆ ਕਵਾਲਟੀ ਦੇ ਵਿੱਚ ਹੋਰ ਬੈੱਡ ਹੋਰ ਦੇਖ ਕੇ ਲੈ ਕੇ ਜਾਵਾਂਗੇ ਇਹ ਅਸੀਂ ਵਾਪਸ ਕਰਨਾ ਚਾਹੁੰਦੇ ਇਹ ਇਹ ਇਹ ਕਿੰਨਾ ਇਹ ਕਿੰਨੇ ਵਜੇ ਤੱਕ ਤੁਹਾਡੀ ਦੁਕਾਨ ਕਿੰਨੇ ਵਜੇ ਤੱਕ ਖੁੱਲ੍ਹੀ ਰਹਿੰਦੀ ਆ ਚੌਵੀ ਘੰਟੇ ਤਾਂ ਰਹਿੰਦੀ ਆ ਅਤੇ ਅਸੀਂ ਕਦੋਂ ਮਰਜੀ ਆ ਸਕਦੇ ਹਾਂ ਦੁਪਹਿਰ ਸਵੇਰੇ ਸ਼ਾਮ ਜਦੋਂ ਮਰਜੀ ਆ ਸਕਦੇ ਹਾਂ ਹਾਂਜੀ ਅੱਛਾ ਤੁਸੀਂ ਤੁਸੀਂ ਤਾਂ ਕਰ ਲਿਓ ਨਾ ਫਿਰ ਜੇ ਅਸੀਂ ਜੀ ਚਲੋ ਫਿਰ ਅਸੀਂ ਦੇਖਦੇ ਹਾਂ ਕਿਸੇ ਬਸ ਫਿਰ ਬਾਅਦ 'ਚ ਦੇਖਾਂਗੇ ਸੇਵਾ ਜੇ ਸਾਨੂੰ ਇਹ ਸੈੱਟ ਬੈਠ ਗਿਆ ਵਧੀਆ ਸਾਨੂੰ ਵਧੀਆ ਕਵਾਲਿਟੀ ਦੀ ਚੀਜ਼ ਮਿਲੂਗੀ ਤਾਂ ਅਸੀਂ ਹੋਰ ਵੀ ਹੋਰ ਵੀ ਸਮਾਨ ਤੁਹਾਡੀ ਦੁਕਾਨ ਤੋਂ ਲੈ ਕੇ ਜਾਵਾਂਗੇ ਹਾਂਜੀ ਜਿਵੇਂ ਮੇਜ ਵਗੈਰਾ ਕੁਰਸੀਆਂ ਵੀ ਹੁੰਦੀਆਂ ਠੀਕ ਹੈ ਜੀ ਅਤੇ ਆ ਬੱਚਿ ਹਾਂ ਬੱਚਿਆਂ ਵਾਸਤੇ ਹੁੰਦੀਆਂ ਜਿਵੇਂ ਬੱਚਿਆਂ ਦੀਆਂ ਪੁਸਤਕਾਂ ਰੱਖਣ ਵਾਸਤੇ ਅਲਮਾਰੀ ਛੋਟੀਆਂ ਅਲਮਾਰੀਆਂ ਹੁੰਦੀਆਂ ਅਤੇ ਇੱਕ ਬੱਚਿਆਂ ਦੇ ਉਹ ਪੜ੍ਹਨ ਵਾਸਤੇ ਜਿਵੇਂ ਆਪਣੇ ਮੰਜੇ 'ਤੇ ਲੈ ਕੇ ਬੈਠ ਜਾਂਦੇ ਹੈ ਇੱਕ ਉਹ ਉਹ ਹੁੰਦਾ ਮੇਜ ਸਟੂਲ ਜਿਹਾ ਹਾਂਜੀ ਹਾਂਜੀ ਉਹ ਵੀ ਹੁੰਦਾ ਜੀ ਚਲੋ ਅਸੀਂ ਫਿਰ ਜਦੋਂ ਹੁਣ ਆਵਾਂਗੇ ਨਾ ਠੀਕ ਹੈ ਜੀ ਜ਼ਰੂਰ ਠੀਕ ਹੈ ਜੀ ਧੰਨਵਾਦ